ਮੈਨੂੰ ਘੁੰਮਣ ਦਾ ਕਾਫੀ ਸ਼ੌਕ ਹੈ ਮੈਂ ਘੁੰਮਣ ਦੇ ਲਈ ਜ਼ਿਆਦਾਤਰ ਪਹਾੜੀ ਏਰੀਆ ਅਤੇ ਠੰਡੇ ਏਰੀਏ ਦੇ ਵਿੱਚ ਜਾਂਦਾ ਹਾਂ ਜਿਵੇਂ ਕਿ ਮੈਨੂੰ ਪਹਾੜੀ ਏਰੀਏ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਡਲਹੌਜ਼ੀ ਅਤੇ ਮਨਾਲੀ ਦੇ ਵਿੱਚ ਘੁੰਮਣਾ ਕਾਫੀ ਪਸੰਦ ਹੈ ਮੈਂ ਤੁਹਾਡੇ ਨਾਲ ਹੁਣ ਮਨਾਲੀ ਦੇ ਵਿੱਚ ਘੁੰਮਣ ਦਾ ਆਪਣਾ ਅਨੁਭਵ ਸਾਂਝਾ ਕਰਦਾ ਹਾਂ ਮੈਂ ਮਨਾਲੀ ਦੇ ਵਿੱਚ ਲਗਭਗ ਦਸੰਬਰ ਦੇ ਮਹੀਨੇ ਦੇ ਵਿੱਚ ਗਿਆ ਸੀ ਦਸੰਬਰ ਦੇ ਮਹੀਨੇ ਦੇ ਵਿੱਚ ਉੱਥੇ ਬਹੁਤ ਹੀ ਜ਼ਿਆਦਾ ਚਿੱਟੇ ਚਿੱਟੇ ਰੰਗ ਦੀ ਬਰਫ ਹੁੰਦੀ ਹੈ ਜੋ ਕਿ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਅਤੇ ਦਿਲ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਉੱਥੇ ਇੱਕ ਇਹੋ ਜਿਹਾ ਸਥਾਨ ਹੈ ਜੋ ਕਿ ਕਾਫੀ ਜ਼ਿਆਦਾ ਉੱਚਾਈ 'ਤੇ ਹੈ ਅਤੇ ਪਹਾੜਾਂ ਦੇ ਵਿੱਚ ਚਿੱਟੀ ਚਿੱਟੇ ਰੰਗ ਦੀ ਬਰਫ ਪੈਂਦੀ ਹੈ ਅਤੇ ਜਦੋਂ ਸੂਰਜ ਚੜ੍ਹਦਾ ਹੈ ਚੜ੍ਹਦੇ ਵੇਲੇ ਸੂਰਜ ਦੀਆਂ ਕਿਰਨਾਂ ਉਸ ਬਰਫ 'ਤੇ ਪੈਂਦੀਆਂ ਹਨ ਤਾਂ ਉਹ ਬਿਲਕੁਲ ਸੋਨੇ ਦੀ ਤਰ੍ਹਾਂ ਚਮਕਦੇ ਦਿਖਾਈ ਦਿੰਦੇ ਹਨ ਜੋ ਕਿ ਦੇਖ ਕੇ ਆਪਣੀਆਂ ਅੱਖਾਂ ਅਤੇ ਦਿਲ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ